ਟੈਕਨੋਲਜੀ ਨੇ ਟਰਾਂਸਪੋਟੇਸ਼ਨ ਨੂੰ ਬਹੁਤ ਹੀ ਆਸਾਨ ਬਣਾਇਆ ਹੈ ਜਿਵੇਂ ਟਿਕੇਟ ਬੁਕਿੰਗ ਕਰਵਾਉਣੀ ਹੋਵੇ ਜਾਂ ਹੋਟਲ ਦੀ ਬੁਕਿੰਗ ਕਰਵਾਉਣੀ ਹੋਵੇ ਅਸੀਂ ਆਪਣੀ ਟੈਕਨੋਲਜੀ ਦੇ ਨਾਲ਼ ਆਪਣੇ ਮੋਬਾਈਲ ਫੋਨ ਨੂੰ ਯੂਸ ਕਰਕੇ ਔਨਲਾਈਨ ਵੀ ਇਹ ਸਭ ਚੀਜ਼ਾਂ ਟਿਕਟ ਬੁਕਿੰਗ ਜਾਂ ਹੋਟਲ ਦੀ ਬੁਕਿੰਗ ਕਰ ਸਕਦੇ ਹਨ ਅੱਪਡੇਟ ਯਾਤਰਾ ਬਾਹਰ ਦਾ ਪਤਾ ਜਾਂ ਪਲੈਟਫੋਮ ਨੰਬਰ ਜੋ ਵੀ ਸਾਨੂੰ ਪਤਾ ਲਗਾਉਣਾ ਹੋਵੇ ਅਸੀਂ ਆਪਣੇ ਫ਼ੋਨ ਦੇ ਰਾਹੀਂ ਟੈਕਨੋਲਜੀ ਨੂੰ ਯੂਸ ਕਰਕੇ ਇਨ੍ਹਾਂ ਸਭ ਚੀਜ਼ਾਂ ਦਾ ਪਤਾ ਲਗਾ ਸਕਦੇ ਹਨ ਟੈਕਨੋਲਜੀ ਨੇ ਸਾਨੂੰ ਚੰਗੀ ਲਾਈਫ ਸਟਾਈਲ ਮੋਰਡਨ ਸੁਵਿਧਾਵਾਂ ਦਿੱਤੀਆਂ ਹਨ ਡਿਜ਼ੀਟਲ ਕਨੈਕਟੀਵਿਟੀ ਅਤੇ ਬਿਹਤਰ ਟੈਕਨੋਲਜੀ ਦੀ ਸੁਵਿਧਾਵਾਂ ਉਪਲਬਧ ਕਰਵਾਈਆਂ ਹਨ ਸਮਾਰਟ ਆਖਰ ਜਿਵੇਂ ਕਿ ਅਸੀਂ ਕਹੀਏ ਕਿ ਟੈਕਨੋਲਜੀ ਨੇ ਨੇ ਟਰਾਂਸਪੋਰਟ ਨੂੰ ਬਹੁਤ ਹੀ ਆਸਾਨ ਬਣਾਇਆ ਹੈ ਜਿਸ ਕਾਰਨ ਸਾਡਾ ਸਮਾਂ ਵੀ ਬੱਚਦਾ ਹੈ ਅਤੇ ਸਾਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੋਟਲ ਦੀ ਬੁਕਿੰਗ ਕਰਨੀ ਹੋਵੇ ਤਾਂ ਅਸੀਂ ਔਨਲਾਈਨ ਘਰ ਬੈਠੇ ਹੀ ਬੁਕਿੰਗ ਕਰ ਸਕਦੇ ਹਨ ਜੇ ਟਿਕਟਾਂ ਦੀ ਬੁਕਿੰਗ ਕਰਨੀ ਹੋਵੇ ਤਾਂ ਅਸੀਂ ਘਰ ਬੈਠੇ ਹੀ ਟਿਕਟ ਦੀ ਬੁਕਿੰਗ ਕਰ ਸਕਦੇ ਹਨ ਜਿਸ ਕਾਰਨ ਸਾਡਾ ਸਮਾਂ ਵੀ ਬੱਚਦਾ ਹੈ ਅੱਪਡੇਟ ਯਾਤਰਾ ਬਾਹਰ ਦਾ ਪਤਾ ਪਲੈਟਫੋਮਸ ਨੰਬਰਸ ਦਾ ਪਤਾ ਕਰਵਾਉਣਾ ਹੋਵੇ ਤਾਂ ਅਸੀਂ ਇਹਨਾਂ ਟੈਕਨੋਲਜੀਆਂ ਦੇ ਰਾਹੀਂ ਹੀ ਇਨ੍ਹਾਂ ਚੀਜ਼ਾਂ ਦਾ ਪਤਾ ਕਰ ਸਕਦੇ ਹਨ